ਖਾਣਾ ਤਾਂ ਹਰ ਕੋਈ ਖਾਂਦਾ ਹੈ ਰੋਜ਼ ਖਾਂਦਾ ਹੈ ਬਟ ਕਿਸੇ ਨਾਲ ਮਿਲ ਕੇ ਖਾਣਾ ਖਾਣਾ ਜਾਂ ਸਾਰਿਆਂ ਨਾਲ ਮਿਲ ਕੇ ਖਾਣਾ ਖਾਣ ਦਾ ਆਨੰਦ ਇੱਕ ਵੱਖਰਾ ਹੀ ਹੁੰਦਾ ਹੈ ਜਦੋਂ ਮੇਰੇ ਛੋਟੇ ਭਰਾ ਦਾ ਬਰਥਡੇ ਆਉਂਦਾ ਹੈ ਤਾਂ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਅਤੇ ਯਾਰਾਂ ਦੋਸਤਾਂ ਨੂੰ ਰਾਤੀ ਡਿਨਰ ਦੇ ਲਈ ਇਨਵਾਈਟ ਕਰਦੇ ਹਾਂ ਜਿਸ ਦੇ ਵਿੱਚ ਅਸੀਂ ਵੱਖ ਵੱਖ ਤਰ੍ਹਾਂ ਦੇ ਭੋਜਨ ਮਿਠਾਈਆਂ ਦਾ ਬੰਦੋਬਸਤ ਕਰਦੇ ਹਾਂ ਇਸ ਤੋਂ ਇਲਾਵਾ ਜਦੋਂ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ ਤਾਂ ਸੰਗਤ ਰੂਪ ਦੇ ਵਿੱਚ ਗੁਰੂ ਘਰ ਦੇ ਲੰਗਰ ਹਾਲ ਦੇ ਵਿੱਚ ਖਾਣਾ ਖਾਣ ਦਾ ਵੱਖਰਾ ਹੀ ਆਨੰਦ ਹੈ ਇਸ ਤੋਂ ਇਲਾਵਾ ਜਦੋਂ ਕਿਸੇ ਦਾ ਕੋਈ ਵਿਆਹ ਸ਼ਾਦੀ ਹੁੰਦਾ ਹੈ ਜਾਂ ਕੋਈ ਧਾਰਮਿਕ ਪ੍ਰੋਗਰਾਮ ਹੁੰਦਾ ਹੈ ਕਿਸੇ ਦੇ ਘਰ ਪਾਠ ਹੈ ਜਾਂ ਜਾਗਰਣ ਹੈ ਉੱਥੇ ਵੀ ਸਾਨੂੰ ਅਲੱਗ ਅਲੱਗ ਤਰ੍ਹਾਂ ਦੇ ਲੋਕਾਂ ਨਾਲ ਖਾਣਾ ਖਾਣ ਦਾ ਮੌਕਾ ਮਿਲਦਾ ਹੈ ਅਲੱਗ ਅਲੱਗ ਤਰ੍ਹਾਂ ਦੇ ਲੋਕਾਂ ਦੇ ਖਾਣਾ ਖਾਣ ਦੇ ਨਾਲ ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਕਿਸ ਤਰ੍ਹਾਂ ਕਿਸੇ ਨਾਲ ਰਲ ਕੇ ਰਹਿਣਾ ਚਾਹੀਦਾ ਹੈ ਸਾਨੂੰ ਉਹਨਾਂ ਦੇ ਬਾਰੇ ਨੌਲੇਜ ਦੇ ਵਿੱਚ ਵਾਧਾ ਹੁੰਦਾ ਹੈ ਹਰ ਇੱਕ ਇਨਸਾਨ ਆਪਣੀ ਅਲੱਗ ਸਮਝ ਰੱਖਦਾ ਹੈ ਆਪਣੀ ਅਲੱਗ ਸੋਚ ਰੱਖਦਾ ਹੈ ਜਦੋਂ ਆਪਾਂ ਕਿਸੇ ਨੂੰ ਮਿਲਾਂਗੇ ਅਤੇ ਉਹ ਆਪਣੀ ਸੋਚ ਕਿਸੇ ਨਾਲ ਸਾਂਝੀ ਕਰਾਂਗੇ ਤਾਂ ਸਾਨੂੰ ਹਰ ਕੋਈ ਆਪਣਾ ਮਹਿਸੂਸ ਹੁੰਦਾ ਹੈ